ਹਾਂ ਸਾਨੂੰ ਲੱਗਦਾ ਹੈ ਕਿ ਆਨਲਾਈਨ ਪੇਮੈਂਟ ਕਰਨਾ ਸਹੀ ਹੈ ਕਿਉਂ ਇਸ ਵਿੱਚ ਇੱਕ ਤਾਂ ਇਨਸਾਨ ਦਾ ਬਹੁਤ ਸਾਰਾ ਸਮਾਂ ਬਚ ਜਾਂਦਾ ਹੈ ਜਿਸ ਨੂੰ ਉਸ ਨੂੰ ਜਿਸ ਕਰਕੇ ਉਸ ਨੂੰ ਥੋੜ੍ਹੀ ਮਿਹਨਤ ਘੱਟ ਕਰਨੀ ਵਿੱਚ ਪੈਂਦੀ ਹੈ ਉਹਦਾ ਆਉਣ ਜਾਣ ਵਿੱਚ ਜਿਹੜਾ ਵਕਤ ਲੱਗਦਾ ਹੈ ਉਹ ਬਚ ਜਾਂਦਾ ਹੈ ਅਤੇ ਉਹ ਜਿੰਨਾਂ ਟਾਈਮ ਇੱਧਰ ਆਉਣ ਜਾਣ 'ਚ ਲਗਾਏਗਾ ਤਾਂ ਉਨੇ 'ਚ ਉਹ ਆਪਦਾ ਕੋਈ ਹੋਰ ਕੰਮ ਕਰ ਸਕਦਾ ਹੈ ਪਰ ਇਹਦੇ 'ਚ ਥੋੜ੍ਹਾ ਜਿਹਾ ਰਿਸਕ ਵੀ ਲੱਗਦਾ ਹੈ ਆਨਲਾਈਨ ਅੱਜ ਕੱਲ੍ਹ ਠੱਗ ਠੱਗ ਬਹੁਤ ਬੈਠੇ ਹੁੰਦੇ ਨੇ ਜੋ ਕਿ ਆਪਦਾ ਨਕਲੀ ਅਕਾਊਂਟ ਬਣਾ ਕੇ ਅਕਾਉਂਟ ਬਣਾ ਕੇ ਪੈਸਾ ਠੱਗ ਲੈਂਦੇ ਹਨ